ਜੇਕਰ ਅਸੀਂ ਦੇਖੀਏ ਤਾਂ ਯੂਟੀਊਬ ਉੱਤੇ ਇੰਟਰਨੈਟ ਉੱਤੇ ਯੋਗਾ ਬਾਰੇ ਇੰਨੀ ਜ਼ਿਆਦਾ ਜਾਣਕਾਰੀ ਉਪਲਬਧ ਹੈ ਇੰਨੀਆਂ ਸਾਰੀਆਂ ਵੀਡੀਓਜ ਹਨ ਜੋ ਸਾਨੂੰ ਯੋਗਾ ਬਾਰੇ ਸਿਖਾਉਂਦੀਆਂ ਹਨ ਯੋਗਾ ਕਿਸ ਤਰ੍ਹਾਂ ਕਰਨਾ ਹੈ ਉਹ ਸਿਖਾਉਂਦੀਆਂ ਹਨ ਅਤੇ ਸਾਨੂੰ ਲੱਗਦਾ ਹੈ ਕਿ ਇਹਨਾਂ ਨੂੰ ਦੇਖ ਕੇ ਅਸੀਂ ਯੋਗਾ ਸਿੱਖ ਸਕਦੇ ਹਾਂ ਸਹੀ ਤਰੀਕੇ ਨਾਲ ਘਰ ਬੈਠੇ ਹੀ ਯੋਗਾ ਕਰ ਸਕਦੇ ਹਾਂ ਔਰ ਮੈਂ ਕੀਤਾ ਵੀ ਕਾਫੀ ਸ਼ੁਰੂਆਤ ਕੀਤੀ ਕਾਫੀ ਕੁਝ ਦੇਖਿਆ ਇੰਟਰਨੈਟ ਉਪਰ ਅਤੇ ਯੋਗਾ ਕਰਨਾ ਸ਼ੁਰੂ ਕਰ ਦਿੱਤਾ ਪਰ ਫਿਰ ਮੈਨੂੰ ਕਿਸੇ ਨੇ ਸਲਾਹ ਦਿੱਤੀ ਕਿ ਮੈਨੂੰ ਯੋਗਾ ਜੋ ਹੈ ਉਹ ਕਿਸੇ ਤਜ਼ਰਬੇਕਾਰ ਇਨਸਾਨ ਕੋਲੋਂ ਸਿੱਖ ਲੈਣਾ ਚਾਹੀਦਾ ਹੈ ਅਤੇ ਜਦੋਂ ਮੈਂ ਆਪਣੀ ਯੋਗਾ ਦੀ ਕਲਾਸ ਲਗਾਉਣੀ ਸ਼ੁਰੂ ਕੀਤੀ ਤਾਂ ਇਹ ਮਹਿਸੂਸ ਕੀਤਾ ਕਿ ਕਿੰਨਾ ਜ਼ਰੂਰੀ ਹੈ ਕੁਝ ਸਿੱਖਣ ਵਾਸਤੇ ਕਿਸੇ ਗੁਰੂ ਦਾ ਹੋਣਾ ਠੀਕ ਹੈ ਅਸੀਂ ਆਪਣੇ ਆਪ ਬਹੁਤ ਕੁਛ ਸਿੱਖ ਕੇ ਸ਼ੁਰੂ ਕਰ ਸਕਦੇ ਹਾਂ ਉਸਨੂੰ ਆਪਣਾ ਸਕਦੇ ਹਾਂ ਲੇਕਿਨ ਜੋ ਸਾਡੇ ਵਿੱਚ ਜੋ ਗਲਤੀਆਂ ਹਨ ਜੋ ਅਸੀਂ ਨਿੱਕੀਆਂ ਨਿੱਕੀਆਂ ਗਲਤੀਆਂ ਕਰਦੇ ਹਾਂ ਯੋਗਾ ਵਿੱਚ ਤਾਂ ਸਾਡਾ ਸਾਹ ਕਦੋਂ ਅੰਦਰ ਜਾਣਾ ਚਾਹੀਦਾ ਹੈ ਕਦੋਂ ਬਾਹਰ ਆਉਣਾ ਚਾਹੀਦਾ ਹੈ ਕਿੰਨਾ ਹੱਥ ਉੱਪਰ ਜਾਣਾ ਚਾਹੀਦਾ ਹੈ ਥੱਲੇ ਆਉਣਾ ਚਾਹੀਦਾ ਹੈ ਇਹ ਸਭ ਕਿਸ ਦੇ ਦੱਸਣਾ ਕਿੰਨਾ ਜ਼ਰੂਰੀ ਹੈ ਇਹ ਮੈਨੂੰ ਉਦੋਂ ਮਹਿਸੂਸ ਹੋਇਆ ਜਦੋਂ ਮੈਂ ਇੱਕ ਤਜ਼ਰਬੇਕਾਰ ਇਨਸਾਨ ਕੋਲੋਂ ਯੋਗਾ ਦੀ ਕਲਾਸ ਲਗਾ ਕੇ ਯੋਗਾ ਸਿੱਖਿਆ